ਜੀ ਹਾਂ ਮੈਂ ਆਪਣੇ ਘਰ ਦੀ ਨਿਗਰਾਨੀ ਕਰਨ ਲਈ ਸੀ ਸੀ ਟੀ ਵੀ ਕੈਮਰੇ ਦਾ ਉਪਯੋਗ ਕਾਫੀ ਸਮੇਂ ਕੀਤਾ ਹੈ ਜਦ ਮੈਂ ਦਿੱਲੀ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਸੀ ਤਾਂ ਆਪਣੇ ਘਰ ਨੂੰ ਸੁਰੱਖਿਅਤ ਰੱਖਣ ਲਈ ਸੀ ਸੀ ਟੀ ਵੀ ਉੱਪਰ ਨਿਗਰਾਨੀ ਕਰਦਾ ਸੀ ਅਤੇ ਜਦ ਵੀ ਮੇਰਾ ਦਿਲ ਕਰਦਾ ਸੀ ਫੋਨ ਉੱਪਰ ਮੈਂ ਆਪਣੇ ਘਰ ਦਾ ਦ੍ਰਿਸ਼ ਦੇਖ ਸਕਦਾ ਸੀ ਮੇਰਾ ਅਨੁਭਵ ਇਸ ਸੁਰੱਖਿਆ ਵਿਵਸਥਾ ਬਾਰੇ ਵਧੀਆ ਹੀ ਰਿਹਾ ਹੈ ਇਸ ਨਾਲ ਸਾਨੂੰ ਆਪਣੇ ਘਰ ਦੀ ਸੁਰੱਖਿਆ ਬਾਰੇ ਜਾਣੂ ਬਹੁਤ ਹੀ ਸੌਖਾ ਹੋ ਜਾਂਦਾ ਹੈ ਅਤੇ ਜੇਕਰ ਕੋਈ ਸਮੱਸਿਆ ਦਿਖਾਈ ਦਿੰਦੀ ਹੈ ਤਾਂ ਅਸੀਂ ਤੁਰੰਤ ਫੋਨ ਉੱਪਰ ਹੀ ਕਿਸੇ ਆਪਣੇ ਸਾਥੀ ਨੂੰ ਫੋਨ ਕਰਕੇ ਉਸਦਾ ਹੱਲ ਕਰਨ ਲਈ ਕਹਿ ਸਕਦੇ ਹਾਂ